ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਅਸੀਂ ਦੇਖਦੇ ਕਿ ਹਰ ਮਹੀਨੇ ਕੋਈ ਨਾ ਕੋਈ ਦਿਨ ਤਿਉਹਾਰ ਜੋ ਹੈ ਉਹ ਮਨਾਇਆ ਜਾਂਦਾ ਹੈ ਔਰ ਸਭ ਤੋਂ ਵੱਡੀ ਇੱਕ ਖਾਸੀਅਤ ਦੀ ਗੱਲ ਹੈ ਕਿ ਪੰਜਾਬ 'ਚ ਹਰੇਕ ਧਰਮ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ ਹਰੇਕ ਧਰਮ ਦਾ ਜੋ ਦਿਨ ਤਿਉਹਾਰ ਹੈ ਉਹ ਮਨਾਇਆ ਜਾਂਦਾ ਹੈ ਅਸੀਂ ਸ਼ੁਰੂਆਤ ਕਰਦੇ ਹਾਂ ਜਨਵਰੀ ਮਹੀਨੇ ਤੋਂ ਜ ਜਨਵਰੀ ਮਹੀਨੇ 'ਚ ਅਸੀਂ ਦੇਖਦੇ ਕਿ ਲੋਹੜੀ ਦਾ ਤਿਉਹਾਰ ਬੜਾ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਇਹ ਲੋਹੜੀ ਦਾ ਤਿਉਹਾਰ ਮੁੰਡੇ ਹੋਣ ਦੀ ਖੁਸ਼ੀ ਵਿੱਚ ਜੋ ਪਰ ਅੱਜ ਕੱਲ੍ਹ ਕੁੜੀ ਦੇ ਹੋਣ ਦੀ ਖੁਸ਼ੀ ਵਿੱਚ ਵੀ ਮਨਾਇਆ ਜਾਂਦਾ ਹੈ ਮੁੰਡੇ ਦੀ ਵਿਆਹ ਦੀ ਖੁਸ਼ੀ 'ਚ ਵਿੱਚ ਵੀ ਮਨਾਇਆ ਜਾਂਦਾ ਹੈ ਠੀਕ ਹੈ ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਇਨ ਇਸ ਮਹੀਨੇ ਵਿੱਚ ਬਸੰਤ ਦਾ ਜੋ ਤਿਉਹਾਰ ਹੈ ਉਹ ਬੜਾ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਮਾਰਚ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ ਅਪ੍ਰੈਲ ਮਹੀਨੇ 'ਚ ਮਨਾਇਆ ਜਾਂਦਾ ਹੈ ਸੋ ਮਤਲਬ ਕਿ ਪੰਜਾਬ ਵਿੱਚ ਹਰੇਕ ਮਹੀਨੇ ਵਿੱਚ ਕੋਈ ਨਾ ਕੋਈ ਦਿਨ ਤਿਉਹਾਰ ਨ ਬੜੇ ਹੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਅਗਰ ਮੈਂ ਗੱਲ ਕਰਾਂ ਵਰਤਮਾਨ ਸਮੇਂ ਵਿੱਚ ਤਾਂ ਕੁਛ ਸਾਲਾਂ ਪਹਿਲੇ ਕਰੋਨਾ ਦੇ ਕਾਰਨ ਲੋਕਾਂ ਵਿੱਚ ਇੱਕ ਦਿਲਚਸਪੀ ਘੱਟ ਗਈ ਸੀ ਪਰ ਇਸ ਸਾਲ ਅਸੀਂ ਜੋ ਦੇਖ ਰਹੇ ਹਾਂ ਕਿ ਲੋਕਾਂ ਨੇ ਮੁਡ ਮੁੜ ਦੁਬਾਰਾ ਆਪਣੀ ਜੋ ਦਿਨ ਤਿਉਹਾਰ ਹੈ ਉਹ ਨਵੇਂ ਸਿਰੇ ਤੋਂ ਮਨਾਉਣੇ ਸ਼ੁਰੂ ਕਰਤੇ ਹਨ ਪਹਿਲੇ ਵਾਂਗ ਹੀ ਚਹਿਲ ਪਹਿਲ ਨਾਲ਼ ਆਪਣੇ ਦਿਨ ਤਿਉਹਾਰ ਨੂੰ ਮਨਾ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ